ਤਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਬਦਲਿਆ ਹੈ ਅਤੇ ਇਹ ਅ ਸਮਾਰਟ ਫ਼ੋਨ ਸਾਡੀ ਸਾਡੀ ਸਹਾਇਤਾ ਬਹੁਤ ਹੀ ਕਰਦਾ ਹੈ ਜਿਵੇਂ ਕਿ ਆਪਾਂ ਕਿਤੇ ਜਾਣਾ ਹੋਵੇ ਤਾਂ ਕੈਬ ਬੁੱਕ ਕਰਾ ਸਕਦੇ ਹਾਂ ਅਤੇ ਆਪਾਂ ਇੰਟਰਨੈੱਟ 'ਤੇ ਯੂਟਿਊਬ 'ਤੇ ਜਾ ਕੇ ਆਪਾਂ ਅੱਜ ਦੀ ਤਾਜ਼ਾ ਖ਼ਬਰ ਬਾਰੇ ਵੀ ਜਾਣ ਸਕਦੇ ਹਾਂ ਘਰ ਬੈਠੇ ਆਪਾਂ ਨੂੰ ਸਾਰੀ ਨਿਊਜ਼ ਮਿਲ ਜਾਂਦੀ ਹੈ ਵੀ ਦੁਨੀਆ 'ਚ ਕੀ ਹੋ ਰਿਹਾ ਕੀ ਨਹੀਂ ਸਾਰੀ ਇਹ ਖ਼ਬਰ ਮਿਲ ਜਾਂਦੀ ਹੈ ਇਸ ਕਾਰਨ ਸਾਨੂੰ ਇਸ ਦੇ ਬਹੁਤ ਹੀ ਫਾਇਦੇ ਮਿਲਦੇ ਹਨ ਜੋ ਕਿ ਆਪਾਂ ਘਰ ਬੈਠੇ ਹੀ ਸਾਰੀ ਦੁਨੀਆ ਦੀ ਜਾਣਕਾਰੀ ਦੇਖ ਸਕਦੇ ਹਾਂ